ਮੈਂ ਅੰਸ਼ੁਲ ਮੈਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਮੇਰੇ ਹਿਸਾਬ ਨਾਲ ਜ਼ਿੰਦਗੀ ਵਿੱਚ ਕਲਾ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਅਤੇ ਇਹ ਇਸ ਕਰਕੇ ਹੈ ਕਿਉਂਕਿ ਮੇਰੇ ਹਿਸਾਬ ਨਾਲ ਜ਼ਿੰਦਗੀ ਵੀ ਇੱਕ ਕਲਾ ਹੈ ਕਿਉਂਕਿ ਜੇ ਅਸੀਂ ਵੇਖੀਏ ਕਿ ਕਲਾ ਅਸੀਂ ਕਿਸ ਨੂੰ ਆਖਦੇ ਹਾਂ ਕਲਾ ਅਸੀਂ ਮੇਰੇ ਹਿਸਾਬ ਨਾਲ ਇੱਕ ਟੈਲੈਂਟ ਨੂੰ ਵੀ ਆਕ ਆਖ ਸਕਦੇ ਹਾਂ ਅਤੇ ਜੇ ਅਸੀਂ ਕਲਾ ਨੂੰ ਮਤਲਬ ਇੱਕ ਛੋਟਾ ਜਿਹਾ ਤਰੀਕੇ ਨਾਲ ਉਸਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਕਲਾ ਉਹ ਹੈ ਕਿ ਜਿਸ ਨੂੰ ਅਸੀਂ ਸਿੱਖਣਾ ਚਾਹੁੰਦੇ ਹਾਂ ਜਾਂ ਕਲਾ ਉਹ ਹੈ ਜੋ ਅਸੀਂ ਕੰਮ ਕਰਦੇ ਹਾਂ ਅਤੇ ਜ਼ਿੰਦਗੀ ਵਿੱਚ ਕਲਾ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਜੇ ਜ਼ਿੰਦਗੀ ਵਿੱਚ ਕਲਾ ਨਾ ਹੋਵੇ ਮੇਰੇ ਹਿਸਾਬ ਨਾਲ ਤੇ ਤਾਂ ਜ਼ਿੰਦਗੀ ਅਧੂਰੀ ਹੈ ਕਿਉਂਕਿ ਕਲਾ ਸਾਨੂੰ ਜ਼ਿੰਦਗੀ ਨਾਲ ਲੜਨ ਦੀ ਲੜਨ ਦੀ ਪ੍ਰੇਰਨਾ ਦਿੰਦੀ ਹੈ ਜਿਵੇਂ ਕਿ ਦੇਖੋ ਜਿਵੇਂ ਕਿ ਇੱਕ ਕਲਾਕਾਰ ਸ਼ੁਰੂ ਤੋਂ ਇੱਕ ਇੱਕ ਸਟੈਪ ਤੋਂ ਚੱਲ ਕੇ ਅੰਤ ਤੱਕ ਆਪਣੀ ਕਲਾ ਕਲਾ ਨੂੰ ਦਰਸਾਉਂਦਾ ਅਤੇ ਬਿਲਕੁਲ ਮਤਲਬ ਕਿ ਹਰ ਇੱਕ ਸਟੈਪ ਉਹ ਆਰਾਮ ਨਾਲ ਆਰਾਮ ਆਰਾਮ ਨਾਲ ਕਰਦਾ ਅਤੇ ਬਿਲਕੁਲ ਧਿਆਨ ਲਗਾ ਕੇ ਕਰਦਾ ਜੋ ਕਿ ਇੱਕ ਬਿਲਕੁਲ ਧਿਆਨ ਦੇਣ ਵਾਲਾ ਕੰਮ ਹੈ ਕਿਉਂਕਿ ਜੇ ਕਿਤੇ ਵੀ ਇੱਕ ਗਲਤੀ ਇੱਕ ਵਾਰ ਗਲਤੀ ਹੋ ਜਾਵੇ ਤਾਂ ਉਸਨੂੰ ਠੀਕ ਕਰਨਾ ਬਹੁਤ ਔਖਾ ਠੀਕ ਤਾਂ ਚਲੋ ਹੋ ਜਾਏਗੀ ਪਰ ਕਦੇ ਕਦੇ ਉਸ ਨੂੰ ਠੀਕ ਕਰਨਾ ਬਹੁਤ ਔਖਾ ਅਤੇ ਉੱਦਾਂ ਹੀ ਜ਼ਿੰਦਗੀ 'ਚ ਆ ਜੇ ਜ਼ਿੰਦਗੀ 'ਚ ਮਤਲਬ ਅਸੀਂ ਕੋਈ ਗਲਤੀ ਕਰਦੇ ਹਾਂ ਅਤੇ ਅਸੀਂ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਦੇ ਕਦੇ ਤਾਂ ਗਲਤੀ ਜੇ ਛੋਟੀ ਹੋਵੇ ਤਾਂ ਉਹ ਠੀਕ ਹੋ ਜਾਂਦੀ ਹੈ ਅਤੇ ਜੇ ਬਾਏ ਚਾਂਸ ਗਲਤੀ ਕੁਛ ਜ਼ਿਆਦਾ ਵੱਡੀ ਹੋ ਜਾਵੇ ਤਾਂ ਉੱਥੇ ਹੀ ਉਹ ਨਿਸ਼ਾਨ ਰਹਿ ਜਾਂਦਾ ਅਤੇ ਜ਼ਿੰਦਗੀ ਅਤੇ ਕਲਾ ਆਪਸ ਵਿੱਚ ਇੰਝ ਹੀ ਮੇਲ ਖਾਂਦੇ ਹਨ ਅਤੇ ਮੇਰੇ ਹਿਸਾਬ ਨਾਲ ਅੰਤ ਵਿੱਚ ਮੈਂ ਇਹੀ ਕਹਿ ਰਿਹਾਂ ਕਿ ਜ਼ਿੰਦਗੀ ਵਿੱਚ ਕਲਾ ਦੀ ਬਹੁਤ ਅਹਿਮੀਅਤ ਹੈ ਅਤੇ ਸਾਨੂੰ ਜ਼ਿੰਦਗੀ ਵਿੱਚ ਕਲਾ ਦਾ ਇਸਤੇਮਾਲ ਤਾਂ ਕਰਨਾ ਹੀ ਚਾਹੀਦਾ ਅਤੇ ਕਲਾ ਕੋਲੋਂ ਕੁਝ ਸਿਖਣਾ ਚਾਹੀਦਾ ਕਿ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਉਤਾਰ ਸਕਦੇ ਹਾਂ ਅਤੇ ਇਹ ਸਾਡੀ ਮਦਦ ਐਵੇਂ ਕਰਦੀ ਹੈ ਕਿ ਸਾਡੀ ਜ਼ਿੰਦਗੀ ਨੂੰ ਹੋਰ ਬਿਹਤਰ ਕਰ ਸਕਦੀ ਹੈ ਕਿਉਂਕਿ ਸਾਨੂੰ ਕੁਝ ਨਾ ਕੁਝ ਕਲਾ ਤੋਂ ਸਿੱਖਣ ਨੂੰ ਮਿਲੇਗਾ ਉਹ ਅਸੀਂ ਆਪਣੀ ਜ਼ਿੰਦਗੀ ਵਿੱਚ ਕਰਾਂਗੇ ਚੰਗੇ ਕੰਮ ਕਰਾਂਗੇ ਅਤੇ ਸਾਡੀ ਜ਼ਿੰਦਗੀ ਹੋਰ ਬਿਹਤਰ ਹੋ ਜਾਵੇਗੀ ਤਾਂ ਜ਼ਿੰਦਗੀ ਦੀ ਅਹਿਮੀਅਤ ਹੈ ਕਲਾ ਦੇ ਕਲਾ ਦੇ ਨਾਲ ਕਿਉਂਕਿ ਇਹ ਦੋਨੋਂ ਆਪਸ ਵਿੱਚ ਮੇਲ ਖਾਂਦੇ ਹਨ ਜ਼ਿੰਦਗੀ ਅਤੇ ਕਲਾ ਇਹ ਇੱਕੋ ਜਿਹੇ ਹਨ ਅਤੇ ਇਹ ਸਾਡੀ ਮਦਦ ਇੰਝ ਹੀ ਕਰਦੀ ਹੈ ਕਿ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ 'ਚ ਧੰਨਵਾਦ